ਭੰਗੜਾ ਸਾਡੇ ਪੰਜਾਬ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਪਹਿਰਾਵਾ ਕੁੜਤਾ ਚਾਦਰਾ ਅਤੇ ਤੁਰਲੇ ਵਾਲੀ ਪੱਗ ਬੰਨ੍ਹ ਕੇ ਕੀਤਾ ਜਾਂਦਾ ਹੈ ਇਹ ਸਾਰੇ ਗੱਭਰੂ ਜਵਾਨ ਆਪਸ ਵਿੱਚ ਮਿਲ ਕੇ ਟੋਲੀਆਂ ਬਣਾ ਕੇ ਇਸ ਦਾ ਪ੍ਰਦਰਸ਼ਨ ਕਰਦੇ ਹਨ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਇਹਨਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਪਹਿਲਾਂ ਵਾਲੇ ਸਮਿਆਂ ਵਿੱਚ ਸਾਡੇ ਬਜ਼ੁਰਗ ਕੁੜਤਾ ਚਾਦਰਾ ਬੰਨ੍ਹ ਕੇ ਅਤੇ ਪੱਗ ਬੰਨ੍ਹ ਕੇ ਇਸਦਾ ਪ੍ਰਦਰਸ਼ਨ ਕਰਦੇ ਸਨ ਅਤੇ ਆਪ ਰਲ ਮਿਲ ਕੇ ਭੰਗੜਾ ਪਾਉਂਦੇ ਸਨ ਹੁਣ ਦੇ ਸਮੇਂ ਵਿੱਚ ਇਸ ਨੂੰ ਬਹੁਤ ਹੀ ਨਵੇਂ ਤਰੀਕਿਆਂ ਨਾਲ ਤਬਦੀਲ ਕੀਤਾ ਗਿਆ ਹੈ ਜਿਵੇਂ ਕਿ ਕੁੜਤੇ ਨਾਲ ਜੀਨ ਪਾ ਕੇ ਇਹਦਾ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ ਅਤੇ ਕੁੜਤਾ ਅਤੇ ਇਕੱਲਾ ਕੁੜਤਾ ਪਜਾਮਾ ਪਾ ਕੇ ਵੀ ਇਸਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਇਸ ਨੂੰ ਹੋਰ ਵੀ ਕਈ ਕਈ ਤਰੀਕਿਆਂ ਨਾਲ ਪਰਸ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਜਿਸ ਨਾਲ ਭੰਗੜੇ ਦੇ ਪ੍ਰਦਰਸ਼ਨ ਵਿੱਚ ਕਈ ਤਬਦੀਲੀਆਂ ਆਈਆਂ ਸਨ ਇਸ ਦੇ ਪਹਿਰਾਵੇ ਵਿੱਚ ਵੀ ਕਈ ਤਪਲੀ ਤਬਦੀਲੀਆਂ ਆਈਆਂ ਹਨ ਸਕੂਲਾਂ ਵਿੱਚ ਡਾਂਸ ਕਰਨ ਲਈ ਹੋਰ ਪਹਿਰਾਵਿਆਂ ਦੀ ਵਰਤੋਂ ਹੋਣ ਲੱਗ ਗਈ ਹੈ ਅਤੇ ਇਸ ਵਿੱਚ ਵੀ ਬਹੁਤ ਤਬਗੀ ਤਬਦੀਲੀ ਆਈ ਹੈ ਭੰਗੜਾ ਸਾਡੇ ਪੰਜਾਬ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਰਿਹਾ ਹੈ ਪੁਰਾਣੇ ਸਮੇਂ ਵਿੱਚ ਇਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਜਾਂਦਾ ਸੀ ਜੋ ਕਿ ਅੱਜ ਦੇ ਸਮੇਂ ਵਿੱਚ ਵੀ ਮੌਜੂਦ ਹੈ ਪਰ ਇਸ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਆਈ ਹੈ ਜਿਵੇਂ ਕਿ ਜੀਨ ਨਾਲ ਕੁੜਤਾ ਪਾ ਕੇ ਇਸਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਕੁੜੀਆਂ ਮੁੰਡੇ ਆਪਸ ਵਿੱਚ ਮਿਲ ਕੇ ਇਸ ਦਾ ਪ੍ਰਦਰਸ਼ਨ ਕਰਦੇ ਹਨ ਵਧੀਆ ਗੱਭਰੂ ਜਵਾਨ ਮਿਲ ਕੇ ਭੰਗੜੇ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਹੋਰ ਵੀ ਡਾਂਸ ਮੌਜੂਦ ਕਰਦੇ ਹਨ ਅਤੇ ਇਸਦਾ ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਕਈ ਪਹਿਰਾਵੇ ਸਾਹਮਣੇ ਆ ਰਹੇ ਹਨ ਜਿਵੇਂ ਕਿ ਕੁੜਤਾ ਚਾਦਰਾ ਜੀਨ ਨਾਲ ਕੁੜਤਾ ਅਤੇ ਇਕੱਲਾ ਕੁੜਤਾ ਪਜਾਮਾ ਤੁਰਲੇ ਵਾਲੀ ਪੱਗ ਇੱਦਾਂ ਬੰਨ੍ਹ ਕੇ ਭੰਗੜੇ ਦਾ ਵਧੀਆ ਪ੍ਰਦਰਸ਼ਨ ਕੀਤਾ ਜਾਂਦਾ ਹੈ ਸਕੂਲਾਂ ਕਾਲਜਾਂ ਵਿੱਚ ਸਟੇਜ 'ਤੇ ਇਸ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ